ਸਤਿ ਸ਼੍ਰੀ ਅਕਾਲ ਸਾਰੇ ਯਾਰਾਂ ਨੂੰ ਮੈਂ ਰਮਨਦੀਪ ਸਿੰਘ ਆਪ ਸਭ ਦਾ ਹਰਮਨ ਪਿਆਰਾ ਆਪ ਦੇ ਵਿੱਚ ਪੰਜਾਬੀ ਰੀਤੀ ਰਿਵਾਜਾਂ ਦੇ ਜਿਹੜੇ ਆ ਉਹਦੇ ਵਿੱਚ ਕੀ ਰੀਤੀ ਰਿਵਾਜ ਆ ਪੰਜਾਬੀ ਵਿਆਹ ਦੇ ਵਿੱਚ ਕੀ ਰੀਤੀ ਰਿਵਾਜ ਵਾ ਉਹਨਾਂ ਦੇ ਬਾਰੇ ਗੱਲ ਕਰਨ ਜਾ ਰਿਹਾ ਵਾਂ ਪੰਜਾਬ ਦੇ ਵਿੱਚ ਵੱਖ ਵੱਖ ਧਰਮ ਜਾਤੀ ਦੇ ਲੋਕ ਰਹਿੰਦੇ ਆ ਜਿਹੜੇ ਕਿ ਵੱਖ ਵੱਖ ਥਾਵਾਂ ਤੋਂ ਆ ਕੇ ਇੱਥੇ ਵਸੇ ਹੋਏ ਆ ਉਹਨਾਂ ਦੇ ਬਾਰੇ ਕੁਛ ਵਿਚਾਰ ਵਿਮਸ਼ ਕਰਨ ਜਾ ਰਹੇ ਹਾਂ ਹੈਂਜੀ ਜਿਹੜੇ ਪੰਜਾਬੀ ਵਿੱਚ ਜਿਹੜੇ ਕਈ ਸਿੱਖ ਫੈਮਿਲੀਜ਼ ਵਾ ਉਹ ਜਿਹੜੇ ਆ ਚਾਰ ਲਾਵਾਂ ਲੈਂਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਿਹੜੀਆਂ ਲਾਵਾਂ ਵਾਂ ਚਾਰ ਗੁਰੂ ਰਾਮਦਾਸ ਜੀ ਦੀਆਂ ਦੇਣ ਵਾਂ ਇਹਨਾਂ ਨੇ ਆਖਿਆ ਸੀ ਵੀ ਚਾਰ ਲਾਵਾਂ ਲਿਆ ਕਰੋ ਅਤੇ ਤਾਂ ਕਿ ਤੁਹਾਡਾ ਜਿਹੜਾ ਜੀਵਨ ਜਿਹੜਾ ਵਾ ਉਹ ਸੁਖੀ ਸ਼ਾਂਤੀ ਜਿਹੜਾ ਬਤੀਤ ਹੋਵੇ ਠੀਕ ਹੈ ਇਸ ਤੋਂ ਬਾਅਦ ਰੀਤੀ ਰਿਵਾਜਾਂ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਰੀਤੀ ਰਿਵਾਜ ਆ ਜਾਂਦੇ ਹਨ ਜਿਹੜੇ ਕਿ ਪੰਜਾਬੀ ਕਲਚਰ ਦੇ ਵਿੱਚ ਲੋਕ ਫੋਲੋ ਕਰਦੇ ਹਨ ਜਿਹਦੇ ਵਿੱਚ ਗਾਨੇ ਖੇਡਣੇ ਆ ਜਾਂਦੇ ਹਨ ਅਤੇ ਭਾਜੀ ਆ ਜਾਂਦੀ ਆ ਭਾਜੀ ਵੰਡਣੀ ਹੁੰਦੀ ਆ ਮੁੰਡੇ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਨੇ ਇੱਕ ਦੂਸਰੇ ਦੇ ਘਰ ਤੋਹਫੇ ਦਿੰਦੇ ਆ ਵੱਖ ਵੱਖ ਜਿਹੜੇ ਆ ਉਹ ਲੋਕ ਆਉਂਦੇ ਆ ਇੱਕ ਦੂਸਰੇ ਨੂੰ ਆਪਣੇ ਜਿਹੜੇ ਆ ਆਪਣੇ ਜਿਹੜੇ ਕੋਈ ਆਂਢ ਗੁਆਂਢ ਉਹਨਾਂ ਨੂੰ ਬੁਲਾਉਂਦੇ ਆ ਢੋਲ ਵਜਾਉਂਦੇ ਆ ਗਿੱਦਾ ਕਰਦੇ ਆ ਕਿਕਲੀਆਂ ਪਾਉਂਦੀਆਂ ਭੈਣਾਂ ਨੱਚਦੇ ਟੱਪਦੇ ਢੋਲ ਵੱਜਦੇ ਆ ਸਾਰੇ ਜਣੇ ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਰਹਿੰਦੇ ਆ ਹੱਸਦੇ ਖੇਡਦੇ ਆ ਟਾਈਮ ਸਪੈਂਡ ਕਰਦੇ ਆ ਅਤੇ ਬਹੁਤ ਹੀ ਵਧੀਆ ਟਾਈਮ ਸਪੈਂਡ ਕਰਦੇ